ਹਾਂਜੀ ਮੈਂ ਜੀ ਔਨਲਾਈਨ ਬਹੁਤ ਪ੍ਰੋਡਕਟ ਯੂਜ਼ ਕਰ ਚੁੱਕਾ ਪਰ ਜੋ ਮ ਕਿ ਮੈਨੂੰ ਸਭ ਤੋਂ ਵਧੀਆ ਪ੍ਰੋਡਕਟ ਜਿਹੜਾ ਆਇਆ ਹੁਣ ਤੱਕ ਦਾ ਉਹ ਇਹ ਆਇਆ ਕਿ ਮੈਂ ਆਪਣੇ ਘਰ ਵਾਸਤੇ ਚੇਅਰ ਕੁਰਸੀ ਮੰਗਵਾਈ ਸੀ ਜੀ ਕੁਰਸੀ ਮੰਗਵਾਈ ਸੀ ਉਹ ਮੈਂ ਔਨਲਾਈਨ ਪ੍ਰੋਡਕਟ ਕੀਤਾ ਸੀ ਔਨਲਾਈਨ ਔਡਰ ਅਤੇ ਉਹ ਜਦੋਂ ਮੇਰੇ ਘਰ ਆਈ ਪਹਿਲਾਂ ਤਾਂ ਫਸਟ ਆਫ ਆਲ ਕਿ ਉਹਦੀ ਪੈਕਿੰਗ ਬਹੁਤ ਜ਼ਬਰਦਸਤ ਦਸਤ ਸੀ ਉਹਦੀ ਪੈਕਿੰਗ ਐਡੀ ਕੁ ਜ਼ਬਰਦਸਤ ਸੀ ਕਿ ਵੇਖ ਕੇ ਮਨ ਖੁਸ਼ ਹੋ ਗਿਆ ਫਿਰ ਫਿਰ ਮੈਂ ਜਦੋਂ ਕੁਰਸੀ ਨੂੰ ਬਾਹਰ ਕੱਢਿਆ ਉਹਦੇ 'ਤੇ ਫਿਰ ਮੈਂ ਬੈਠ ਕੇ ਦੇਖਿਆ ਉਹਦਾ ਕਮਫਰਟ ਉਹ ਮਤ ਕਿ ਐਨੀ ਕੁ ਆਰਾਮਦਾਇਕ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤਾਂ ਇਹ ਮੇਰਾ ਪ੍ਰੋਡਕਟ ਬਹੁਤ ਹੀ ਵਧੀਆ ਸੀ